ਸਾਡੇ ਖੇਤਰ ਵਿੱਚ ਬਹੁਤ ਜੇ ਮੌਸਮੀ ਤਿਉਹਾਰ ਮਨਾਏ ਜਾਂਦੇ ਹਨ ਜੋ ਕਿ ਕੇਵਲ ਸਾਡੇ ਰਾਜ ਦੇ ਖੇਤਰ ਵਿੱਚ ਹੀ ਵਿਸ਼ੇਸ ਹਨ ਜਿਵੇਂ ਬਸੰਤ ਪੰਚਮੀ ਹੋਲਾ ਮੁਹੱਲਾ ਵਿਸਾਖੀ ਅਤੇ ਤੀਆਂ ਆਦਿ ਦੇ ਮੁੱਖ ਮੌਸਮੀ ਮੇਲੇ ਹਨ ਇਹਨਾਂ ਵਿੱਚੋਂ ਬਸੰਤ ਪੰਚਮੀ ਬਸੰਤ ਰੁੱਤ ਦੇ ਆਰੰਭ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਥਾਂ ਥਾਂ 'ਤੇ ਨਿੱਕੇ ਵੱਡੇ ਮੇਲੇ ਲੱਗਦੇ ਹਨ ਇਹਨਾਂ ਦਿਨਾਂ ਵਿੱਚ ਲੋਕ ਬਸੰਤੀ ਕੱਪੜੇ ਪਾਉਂਦੇ ਹਨ ਅਤੇ ਬਸੰਤੀ ਹਲਵਾ ਬਣਾਉਂਦੇ ਹਨ ਉਸੀ ਤਰ੍ਹਾਂ ਵਿਸਾਖੀ ਦਾ ਮੇਲਾ ਕਣਕ ਦੀ ਫਸਲ ਪੱਕਣ ਦੇ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਕਿਸਾਨ ਕਾਫੀ ਖੁਸ਼ ਜਾਪਦੇ ਹਨ ਕਿਉਂਕਿ ਉਹਨਾਂ ਦੀ ਕਣਕ ਦੀ ਰਾਖੀ ਜਿਹੜੀ ਹੈ ਉਹ ਖਤਮ ਹੋ ਗਈ ਹੁੰਦੀ ਹੈ ਅਤੇ ਉਹ ਕਾਫੀ ਜੋਸ਼ ਵਿੱਚ ਨਜ਼ਰ ਆਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ